ਬਿਲਕੁਲ ਨੇੜੇ ਦੇ ਧਾਰਮਿਕ ਸਥਾਨ ਸਾਡੇ ਸ਼ਿਵ ਮੰਦਰ ਹੈ ਜਿੱਥੇ ਕਿ ਮੈਂ ਹਰ ਰੋਜ਼ ਸਵੇਰੇ ਸ਼ਾਮ ਜਾਂਦਾ ਅਤੇ ਉੱਥੇ ਜਾ ਕੇ ਮੈਨੂੰ ਅਤੇ ਮੇਰੇ ਮਨ ਨੂੰ ਬਹੁਤ ਹੀ ਸ਼ਾਂਤੀ ਮਹਿਸੂਸ ਹੁੰਦੀ ਹੈ